ਹੈਲੋ ਵੀਰੇ ਮੇਰਾ ਨਾਮ ਮਮਤਾ ਰਾਣੀ ਮੈਂ ਪਿੰਡ ਘੁੱਦਾ ਤੋਂ ਬੋਲ ਰਹੀ ਹਾਂ ਤੁਸੀਂ ਬਰਾੜ ਰੈਸਟੋਰੈਂਟ ਤੋਂ ਬੋਲ ਰਹੇ ਹੋ ਵੀਰੇ ਮੈਂ ਅਸੀਂ ਮੇਰਾ ਬ੍ਰਦਰ ਆਇਆ ਸੀ ਸਾਡੇ ਘਰ ਬਰਡੇ ਪਾਰਟੀ ਸੀ ਤੁਹਾਨੂੰ ਅਸੀਂ ਚਾਰ ਪੀਜ਼ਾ ਅਤੇ ਦਸ ਬਰਗਰ ਓਰਡਰ ਕੀਤੇ ਸੀਗੇ ਗੱਲ ਇਸ ਤਰ੍ਹਾਂ ਵੀਰੇ ਸਾਡੇ ਰਿਸ਼ਤੇਦਾਰਾਂ ਨੇ ਪਲੈਨਿੰਗ ਕੈਂਸਲ ਕਰਤੀ ਉਹਨਾਂ ਨੂੰ ਕੋਈ ਕੰਮ ਪੈ ਚੁੱਕਿਆ ਉਹ ਆ ਨਹੀਂ ਰਹੇ ਗੇ ਇਸ ਕਰਕੇ ਮੈਂ ਤੁਹਾਨੂੰ ਵੀਰੇ ਕਹਿਣਾ ਚਾਹੁੰਦੀ ਸੀ ਵੀ ਸਾਡਾ ਓਰਡਰ ਘਟਾ ਦਿੱਤਾ ਜਾਵੇ ਜੋ ਵੀ ਅਸੀਂ ਖਾਣਾ ਓਰਡਰ ਕੀਤਾ ਸੀ ਉਸ ਦੀ ਕੀਮਤ ਉਸਦੀ ਮਾਤਰਾ ਘਟਾ ਦਿੱਤੀ ਜਾਵੇ ਵੀਰੇ ਸਾਨੂੰ ਦਸ ਬਰਗਰ ਦੀ ਥਾਂ 'ਤੇ ਸੋ ਅਸੀਂ ਪੰਜ ਬਰਗਰ ਦੇ ਦਿਆ ਜੋ ਚਾਰ ਪੀਜੇ ਦੀ ਥਾਂ 'ਤੇ ਸਾਨੂੰ ਦੋ ਪੀਜੇ ਦੇ ਦਿਉ ਅਤੇ ਵੀਰੇ ਸਾਡੀ ਪੇਮੈਂਟ ਆਲਰੈਡੀ ਹੋ ਚੁੱਕੀ ਹੈ ਅਗਰ ਤੁਸੀਂ ਸਾਡੀ ਪੇਮੈਂਟ ਜਿੰਨੀ ਬਣਦੀ ਆ ਓਨੀ ਕੱਟ ਕੇ ਬਾਕੀ ਸਾਡੀ ਪੇਮੈਂਟ ਤੁਸੀਂ ਵਾਪਸ ਕਰ ਦਿਓ ਸਾਡੀ ਬੇਨਤੀ ਹੈ ਵੀਰੇ ਰਿਕੁਐਸਟ ਹੈ ਜੀ ਸਾਡੇ ਓਰਡਰ ਨੂੰ ਘੱ ਮਾਤਰਾ ਨੂੰ ਘਟਾਇਆ ਜਾਵੇ ਤਾਂ ਕਿ ਸਾਡਾ ਜਿਹੜਾ ਖਾਣਾ ਵੀ ਘਰ ਖਰਾਬ ਨਾ ਹੋਵੇ ਨਾ ਵੇਸਟਿੰਗ ਨਾ ਹੋਵੇ ਨਾਲ ਪੈਸੇ ਦੀ ਨਾ ਵੇਸਟਿੰਗ ਹੋਵੇ ਵੀਰੇ ਵੀ ਸਾਡਾ ਪੈਸਾ ਵੀ ਬਚ ਸਕੇ ਅਤੇ ਤੁਸੀਂ ਸਾਡੇ ਓਨੇ ਹੀ ਓਰਡਰ ਦੇ ਪੈਸੇ ਕੱਟੋ ਜਿੰਨੇ ਸਾਡਾ ਤੁਹਾਨੂੰ ਓਰਡਰ ਹੁਣ ਅਸੀਂ ਦੇ ਰਹੇ ਹਾਂ ਅਸੀਂ ਬੇਨਤੀ ਕਰਦੇ ਹਾਂ ਵੀ ਸਾਡੇ ਤੋਂ ਗਲਤੀ ਨਾਲ ਵੀ ਉਹ ਓਰਡਰ ਵੱਧ ਦਿੱਤਾ ਗਿਆ ਰਿਸ਼ਤੇਦਾਰ ਆਉਣੇ ਸੀ ਬਟ ਉਹਨਾਂ ਨੂੰ ਕੋਈ ਕੰਮ ਪੈ ਗਿਆ ਉਹ ਨਹੀਂ ਆ ਰਹੇ ਹੈਗੇ ਇਸ ਕਰਕੇ ਸਾਡੇ ਓਰਡਰ ਦੀ ਮਾਤਰਾ ਘਟਾਓ ਅਤੇ ਅਸੀਂ ਜਿੰਨਾ ਹੁਣ ਤੁਹਾਨੂੰ ਓਰਡਰ ਕਰ ਰਹੇ ਹੋ ਵੀ ਓਨਾ ਓਰਡਰ ਸਾਡਾ ਤੁਸੀਂ ਪਾਸ ਕੀਤਾ ਜਾਵੇ ਥੈਂਕ ਯੂ ਵੀਰੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ